ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਚੌਦਾਂ ਜਨਵਰੀ ਉੱਨੀ ਸੌ ਛਿਆਨਵੇਂ ਪੰਜ ਸਤੰਬਰ ਉੱਨੀ ਸੌ ਚੌਵੀ ਛੇ ਦਸੰਬਰ ਉੱਨੀ ਸੌ ਇੱਕੀ ਸੱਤ ਦਸੰਬਰ ਦੋ ਹਜ਼ਾਰ ਸੱਤ